ਕਾਨੂੰਨੀ ਦਸਤਾਵੇਜ਼ਾਂ ਨੂੰ ਬਣਾਉਣਾ ਬਹੁਤ ਹੀ ਮੁਸ਼ਕਿਲ ਹੈ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਕਿਉਂਕਿ ਪਹਿਲਾਂ ਤਾਂ ਕਾਨੂੰਨੀ ਦਸਤਾਵੇਜ਼ ਬਣਾਉਣ ਤੋਂ ਪਹਿਲਾਂ ਇਹਨਾਂ ਦੇ ਬਾਰੇ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਇਹਨਾਂ ਦੇ ਲਿਖੇ ਹੋਏ ਜਿਹੜੇ ਸ਼ਬਦ ਹੁੰਦੇ ਨੇ ਉਹ ਬਹੁਤ ਡੂੰਘੇ ਹੁੰਦੇ ਨੇ ਕਈ ਵਾਰ ਤਾਂ ਉਹਨਾਂ ਨੂੰ ਸਮਝਣਾ ਬੜਾ ਮੁਸ਼ਕਿਲ ਹੋ ਜਾਂਦਾ ਜਿਹਦੇ ਕਰਕੇ ਸਾਨੂੰ ਕਦੇ ਕਿਸੇ ਇੱਕ ਅਫਸਰ ਕੋਲੋਂ ਕਦੇ ਦੂਸਰੇ ਅਫਸਰ ਕੋਲ ਜਾਣਾ ਪੈਂਦਾ ਔਰ ਉਹਨਾਂ ਅਫਸਰਾਂ ਕੋਲ ਤਾਂ ਕਦੇ ਕਦਾਰ ਤਾਂ ਸਾਡੇ ਲਈ ਇਕੱਲੇ ਇੱਕ ਬੰਦੇ ਦੇ ਲਈ ਟਾਈਮ ਤਾਂ ਨਹੀਂ ਹੁੰਦਾ ਇਸ ਲਈ ਉਹ ਬਹੁਤ ਲੰਬਾ ਉਸ ਚੀਜ਼ ਨੂੰ ਖਿੱਚ ਦਿੰਦੇ ਨੇ ਖ਼ਾਸ ਕਰ ਵਸੀਅਤ ਕਿਉਂਕਿ ਮੇਰਾ ਅਨੁਭਵ ਹੈ ਕਿ ਜਦੋਂ ਮੈਂ ਵਸੀਅਤ ਬਣਾਉਣ ਇੱਕ ਵਾਰੀ ਜਾਣਾ ਸੀ ਤਾਂ ਵਸੀਅਤ ਦੇ ਲਈ ਹੀ ਵਾਰ ਵਾਰ ਵਾਰ ਵਾਰ ਵਾਰ ਵਾਰ ਦੋ ਤਿੰਨ ਵਾਰ ਹੀ ਸਾਨੂੰ ਚੱਕਰ ਲਗਾਉਣੇ ਪਏ ਔਰ ਕਦੇ ਇਹ ਨਹੀਂ ਹੈ ਕਦੇ ਉਹ ਨਹੀਂ ਹੈ ਅਤੇ ਇਸ ਚੀਜ਼ ਨੂੰ ਲੈ ਕੇ ਮੈਨੂੰ ਲੱਗਦਾ ਕਿ ਕਾਨੂੰਨੀ ਜਿਹੜੇ ਦਸਤਾਵੇਜ਼ ਨੇ ਉਹਨਾਂ ਨੂੰ ਬਣਾਉਣਾ ਬਹੁਤ ਹੀ ਜ਼ਿਆਦਾ ਔਖਾ